ਜਿਹੜਾ ਸਰ ਮੈਂ ਪੰਜਾਬੀ ਜਾਂ ਆਪਣੀ ਗਾਇਕੀ ਦਾ ਅਭਿਆਸ ਕਰਦਾ ਹਾਂ ਮਤਲਬ ਉਹ ਮੈਂ ਸਵੇਰ ਤੋਂ ਹੀ ਸਟਾਰਟ ਕਰ ਦਿੰਦਾ ਹੈ ਨਾ ਸਵੇਰੇ ਕੀ ਹੁੰਦਾ ਮਤਲਬ ਸਵੇਰੇ ਮੈਂ ਉੱਠਦਾ ਹਾਂ ਅਤੇ ਗਰਮ ਪਾਣੀ ਵੀ ਪੀਂਦਾ ਸਭ ਤੋਂ ਪਹਿਲਾਂ ਤਾਂ ਹੈ ਨਾ ਗਰਮ ਪਾਣੀ ਨਾਲ ਗਰਾਰੇ ਵਗੈਰਾ ਕਰਦਾ ਹਾਂ ਗਰਮ ਪਾਣੀ ਨਾਲ ਗਰਾਰੇ ਵਗੈਰਾ ਕਰਕੇ ਫਿਰ ਮਤਲਬ ਨਹਾ ਧੋ ਕੇ ਅਤੇ ਮਤਲਬ ਪਾਠ ਪੂਜਾ ਕਰਦਾ ਹਾਂ ਸਰਸਵਤੀ ਮਾਂ ਦੀ ਹੈ ਨਾ ਇਸ ਤੋਂ ਬਾਅਦ ਕੀ ਆ ਮਤਲਬ ਸਭ ਤੋਂ ਜ਼ਿਆਦਾ ਇਹਨਾਂ ਚੀਜ਼ਾਂ ਪੰਜਾਬੀ ਗਾਇਕੀ 'ਚ ਜਾਂ ਕੁਝ ਵੀ ਕਿਸੇ ਚੀਜ਼ 'ਚ ਅਭਿਆਸ ਕਰਨ ਵਾਲੀ ਚੀਜ਼ ਹੁੰਦੀ ਮਤਲਬ ਇਹਦੇ 'ਚ ਪ੍ਰਹੇਜ ਕਰਨਾ ਪੈਂਦਾ ਕੁਛ ਤਲੀਆਂ ਚੀਜ਼ਾਂ ਦਾ ਹੈ ਨਾ ਜਿਹਦੇ ਕਰਕੇ ਮਤਲਬ ਗਲੇ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਮਤਲਬ ਤਲੀਆਂ ਚੀਜ਼ਾਂ ਖਾਵਾਂਗੇ ਜਾਂ ਆਈਸਕ੍ਰੀਮ ਖਾਵਾਂਗੇ ਜਾਂ ਖਟਿਆਈ ਵਾਲੀਆ ਚੀਜ਼ਾਂ ਖਾਵਾਂਗੇ ਕੋਈ ਹੈ ਨਾ ਇਹਦੇ ਵਿੱਚ ਕੀ ਹੁੰਦਾ ਮਤਲਬ ਪ੍ਰੋਬਲਮ ਆ ਜਾਂਦੀ ਗਲਾ ਖ਼ਰਾਬ ਹੋਣ ਦੇ ਕਾਫੀ ਚਾਂਸਸਿਸ ਰਹਿੰਦੇ ਹੈ ਅਤੇ ਜੇ ਮਤਲਬ ਗਲਾ ਖ਼ਰਾਬ ਹੋਉਗਾ ਤਾਂ ਮਤਲਬ ਜਿਹੜਾ ਅਭਿਆਸ ਹੈ ਜਾਂ ਮਤਲਵ ਜਿਹੜੀ ਗਾਇਕੀ ਆ ਉਹ ਸਹੀ ਪ੍ਰੋਪਰ ਤਰੀਕੇ ਨਾਲ ਨਹੀਂ ਹੋਵੇਗੀ ਹੈ ਨਾ ਇਹਦੇ ਵਿੱਚ ਮੈਂ ਮਤਲਬ ਮੇਰੇ ਇਕ ਸਰ ਵੀ ਹੈਗੇ ਹੈ ਹੈ ਨਾ ਜਿਹਨਾਂ ਦਾ ਨਾਮ ਰਣਜੀਤ ਸਿੰਘ ਹੈ ਮਤਲਬ ਉਹਨਾਂ ਤੋਂ ਵੀ ਜਿੱਥੇ ਜਿੱਥੇ ਵੀ ਮੈਨੂੰ ਪ੍ਰੋਬਲਮ ਆਉਂਦੀ ਹੈ ਮੈਂ ਉਹਨਾਂ ਤੋਂ ਵੀ ਮਤਲਬ ਆਹ ਹੈਲਪ ਲੈਂਦਾ ਉਹਨਾਂ ਨੂੰ ਮੈਂ ਮਿਲਦਾ ਰਹਿੰਦਾ ਮੈਂ ਇਹਦੇ ਵਿੱਚ ਮਤਲਬ ਮੈਂ ਦੋ ਜਾਂ ਤਿੰਨ ਘੰਟੇ ਸਵੇਰੇ ਰਿਆਜ਼ ਕਰਦਾ ਅਤੇ ਦੋ ਜਾਂ ਤਿੰਨ ਘੰਟੇ ਸ਼ਾਮ ਨੂੰ ਕਰਦਾ ਕੋਈ ਦੁਪਹਿਰੇ ਮੈਨੂੰ ਟਾਈਮ ਮਿਲੇ ਕਰ ਲੈਂਦਾ ਕਰਦਾ ਮੈਂ ਹੈ ਨਾ ਮਤਲਬ ਇਹਨਾਂ ਦੇ ਵਿੱਚ ਆਪਾਂ ਨੂੰ ਵਾਰੀ ਵਾਰੀ ਬੰਦੇ ਨੂੰ ਅਭਿਆਸ ਹੀ ਕਰਨਾ ਪੈਂਦਾ ਹੈ ਨਾ ਵਾਰੀ ਵਾਰੀ ਬੰਦੇ ਨੂੰ ਪ੍ਰੈਕਟੀਕਲ ਹੀ ਕਰਨਾ ਪੈਂਦਾ ਕਿਉਂਕਿ ਬੰਦਾ ਕੁਛ ਨਾ ਕੁਛ ਕੁਛ ਨਾ ਕੁਛ ਡੇਲੀ ਨਵਾਂ ਸਿੱਖਦਾ ਹੈ ਨਾ ਜੀ ਇਹਦੇ ਵਿੱਚ ਇਹ ਹੀ ਹੈ